ਮੈਨੂੰ ਮੇਰੀ ਫਰੈਂਡ ਮਿਲੀ ਮੈਂ ਜਦੋਂ ਡਰੈਸ ਲੈਣੀ ਸੀ ਤਾਂ ਮੈਂ ਉਸਨੂੰ ਕਿਹਾ ਕਿ ਮੈਂ ਇੱਕ ਨਵੀਂ ਡਰੈਸ ਲੈਣਾ ਚਾਹੁੰਦੀ ਹਾਂ ਅਤੇ ਮੈਨੂੰ ਉਹਨਾਂ ਨੇ ਤੁਹਾਡੀ ਐਡਵਾਈਸ ਦਿੱਤੀ ਕਿ ਤੁਸੀਂ ਔਨਲਾਈਨ ਡ ਡਰੈਸ ਮੰਗਵਾਓ ਮੈਂ ਉਸ ਨੂੰ ਕਿਹਾ ਕਿ ਅਗਰ ਵਿੱਚੋਂ ਕਈ ਵਾਰੀ ਟੁੱਕ ਨਿਕਲ ਆਉਂਦਾ ਹੈ ਅਤੇ ਜੇ ਮੈਨੂੰ ਪੂਰੀ ਨਾ ਆਈ ਤਾਂ ਉਹਨੇ ਮੈਨੂੰ ਬੜਾ ਹੌਸਲਾ ਦਿੱਤਾ ਕਿ ਬਹੁਤ ਅੱਛੀ ਚੀਜ਼ ਦਿੰਦੇ ਹਨ ਫਿਰ ਮੈਂ ਔਨਲਾਈਨ ਦਾ ਤੁਹਾਡੀ ਬੁਕਿੰਗ ਕਰਵਾਈ ਔਰ ਇਹ ਵਿਆਹ ਤੋਂ ਇੱਕ ਦਿਨ ਪਹਿਲਾਂ ਜਦੋਂ ਮੈਨੂੰ ਮਿਲੀ ਅਤੇ ਮੈਂ ਬੜੀ ਐਕਸਾਈਟਡ ਸੀ ਮੈਂ ਉਹ ਡਰੈਸ ਪਾ ਕੇ ਦੇਖੀ ਤਾਂ ਮੈਨੂੰ ਇਹ ਹੀ ਡਾਊਟ ਸੀ ਕਿ ਸ਼ਾਇਦ ਮੇਰੇ ਮਾਪ ਦੀ ਹੋਵੇਗੀ ਕਿ ਨਹੀਂ ਹੋਵੇਗੀ ਪਰ ਜਦੋਂ ਮੈਂ ਪਾਈ ਬਿਲਕੁਲ ਪਰਫੈਕਟ ਫਿਟਿੰਗ ਦੀ ਅਤੇ ਲੰਬਾਈ ਦੀ ਔਰ ਜਦੋਂ ਮੈਂ ਪਾਈ ਤਾਂ ਮੇਰੇ ਫਰੈਂਡ ਸਰਕਲ ਔਰ ਮੇਰੇ ਘਰ ਜਿਹੜੇ ਆਏ ਗੈਸਟ ਸੀ ਉਹ ਕਹਿੰਦੇ ਵਾਓ ਲੁਕਿੰਗ ਸੋ ਬਿਊਟੀਫੁਲ ਇੰਨੀ ਸੁੰਦਰ ਅਤੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਮੈਂ ਮੈਂ ਵੀ ਬਹੁਤ ਖੁਸ਼ ਹੋਈ ਅਤੇ ਮੈਨੂੰ ਬਹੁਤ ਬਹੁਤ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਟਾਈਮ ਤੋਂ ਪਹਿਲਾਂ ਮੈਨੂੰ ਉਹ ਡਰੈਸ ਪਹੁੰਚਾਈ ਤੁਹਾਡੀ ਡਿਲਵਰੀ ਬਹੁਤ ਅੱਛੀ ਹੈ ਔਰ ਮੈਂ ਆਪਣੇ ਫਰੈਂਡ ਸਰਕਲ ਨੂੰ ਵੀ ਕਹਾਂਗੀ ਕਿ ਉਹ ਅੱਗੇ ਤੋਂ ਤੁਹਾਡੇ ਕੋਲ ਸਮਾਨ ਲੈਣ ਅਤੇ ਤੁਹਾਨੂੰ ਬੁਕਿੰਗ ਕਰਵਾਉਣ ਉਹ ਤੁਹਾਡੇ ਕੋਲ ਡਿਲੀਵਰੀ ਲੈਣ ਬਹੁਤ ਬਹੁਤ ਥੈਂਕਸ ਅਗੇਨ ਥੈਂਕਸ